ਜੀ ਹਾਂ ਮੈਂ ਰਵਾਇਤੀ ਤੌਰ 'ਤੇ ਪੈੱਨ ਨਾਲ ਕਾਗਜ਼ 'ਤੇ ਲਿਖਣਾ ਬਹੁਤ ਪਸੰਦ ਕਰਦਾ ਸੀ ਅਤੇ ਹੁਣ ਵੀ ਕਰਦਾ ਹਾਂ ਪਰ ਹੁਣ ਸਮਾਂ ਹੀ ਇੱਦਾਂ ਦਾ ਆ ਗਿਆ ਹੈ ਕਿ ਮੈਂ ਲੈਪਟੋਪ ਮੋਬਾਈਲ 'ਤੇ ਹੀ ਟਾਈਪ ਕਰਦਾ ਹਾਂ ਕਿਉਂਕਿ ਪੈੱਨ ਕੰਨੇ ਪੈਨਸਿਲ ਅਤੇ ਕਾਗਜ਼ 'ਤੇ ਲਿਖਣ ਨਾਲ ਬਹੁਤ ਸਮਾਂ ਬਰਬਾਦ ਹੁੰਦਾ ਸੀ ਅਤੇ ਹੁਣ ਮੈਂ ਮੋਬਾਈਲ ਫੋਨ ਵਿੱਚ ਲਿਖਦਾ ਹਾਂ ਅਤੇ ਸਿੱਧਾ ਹੀ ਜਿਸ ਨੂੰ ਭੇਜਣਾ ਹੁੰਦਾ ਹੈ ਉਸ ਨੂੰ ਭੇਜ ਦਿੰਦਾ ਹਾਂ ਪੈੱਨ ਨਾਲ ਕਾਗਜ਼ 'ਤੇ ਲਿਖਣਾ ਵੀ ਸੌਖਾ ਸੀ ਪਰ ਉਹ ਬਹੁਤ ਹੀ ਮੁਸ਼ਕਿਲ ਸੀ ਇਸ ਕਰਕੇ ਮੈਂ ਸਿੱਧਾ ਹੀ ਮੋਬਾਈਲ 'ਤੇ ਟਾਈਪ ਕਰਦਾ ਹਾਂ ਉਸ 'ਤੇ ਟਰਾਂਸਲੇਟਰ ਵੀ ਖੁੱਲ੍ਹ ਜਾਂਦਾ ਹੈ ਜੇਕਰ ਮੈਂ ਕੁਛ ਪੰਜਾਬੀ 'ਚ ਲਿਖਣਾ ਹੋਵੇ ਤਾਂ ਉਹ ਵੀ ਲਿਖ ਲੈਂਦਾ ਹਾਂ ਉਸ 'ਤੇ ਆਟੋ ਕਰੈਕਟ ਵੀ ਹੁੰਦਾ ਹੈ ਜੇ ਕੁਛ ਆਟੋ ਕਰ ਗਲਤ ਹੋ ਜਾਏ ਉਹ ਖੁਦ ਹੀ ਆਟੋ ਕਰੈਕਟ ਹੋ ਜਾਂਦਾ ਹੈ